ਹਾਂਜੀ ਅੱਜ ਕੱਲ੍ਹ ਦਾ ਯੁੱਗ ਵਿਗਿਆਪਨ ਦਾ ਯੁੱਗ ਹੈ ਅਤੇ ਅਸੀਂ ਹਰੇਕ ਜਗ੍ਹਾ ਦੇਖਦੇ ਹਾਂ ਵਿਗਿਆਪਨ ਅ ਟੈਲੀਵਿਜ਼ਨ ਮੋਬਾਇਲ ਫੋਨ ਹਰੇਕ ਕਿਤੇ ਸੋ ਆਈ ਥਿੰਕ ਸ਼ੋਸ਼ਲ ਮੀਡੀਆ ਕਾਫੀ ਅਵੇਅਰ ਕਰਦਾ ਹੈ ਲੋਕਾਂ ਨੂੰ ਸਰਾਊਡਿੰਗ ਕੀ ਚੱਲ ਰਿਹਾ ਆਲੇ ਦੁਆਲੇ ਕੀ ਚੱਲ ਰਿਹਾ ਅਤੇ ਲੋਕਾਂ ਨੂੰ ਪਤਾ ਹੁੰਦਾ ਹੈ ਵੀ ਕੀ ਚੱਲ ਰਿਹਾ ਕਿਉਂਕਿ ਅੱਜ ਕੱਲ੍ਹ ਕ੍ਰਾਈਮ ਰੇਟ ਬਹੁਤ ਵੱਧ ਗਿਆ ਹੈ ਅੱਜ ਕੱਲ੍ਹ ਸੋ ਮੀਡੀਆ ਅਵੇਅਰ ਕਰਾਉਂਦਾ ਹੈ ਲੋਕਾਂ ਨੂੰ ਅਤੇ ਉਸ ਤੋਂ ਬਾਅਦ ਗਵਰਮੈਂਟ ਵੀ ਕਾਫੀ ਅੱਛਾ ਰੋਲ ਕਰ ਰਿਹਾ ਜਿਹੜੇ ਸੋਸ਼ਲ ਮਵ ਸੋਸ਼ਲ ਐਡਵਰਟੀਸਮੈਂਟ ਦੇ ਰਿਹਾ ਅਤੇ ਲੋਕ ਉਨ੍ਹਾਂ ਤੋਂ ਜਾਣੂ ਹੋ ਰਹੇ ਹੈ ਅਤੇ ਆਈ ਥਿੰਕ ਅੱਛਾ ਮੂਵ ਹੈ ਕਾਫੀ ਅੱਛਾ ਮੂਵ ਹੈ